ਪੰਜਾਬ ਪੰਜਾਬ ਦਾ ਅਰਥ ਹੈ ਪੰਜ ਆਬ ਪੰਜਾਬ ਦੀ ਮੁੱਖ ਬੋਲੀ ਪੰਜਾਬੀ ਹੈ ਜੋ ਕਿ ਸਾਡੇ ਸਕੂਲਾਂ ਵਿੱਚ ਛੋਟੇ ਬੱਚਿਆਂ ਨੂੰ ਸ਼ੁਰੂ ਤੋਂ ਲੈ ਕੇ ਹੀ ਗੁਰਮੁਖੀ ਊੜਾ ਆੜਾ ਪੰਜਾਬੀ ਸਿਖਾਈ ਜਾਂਦੀ ਹੈ ਅਤੇ ਪੰਜਾਬੀ 'ਤੇ ਹੀ ਵੱਧ ਜ਼ੋਰ ਦਿੱਤਾ ਜਾਂਦਾ ਹੈ ਪੰਜਾਬੀ ਬੋਲੀ ਸਾਡੀ ਵਿਆਹ ਸ਼ਾਦੀਆਂ ਵਿੱਚ ਗਿੱਧਾ ਭੰਗੜਾ ਬੋਲੀਆਂ ਪਾਉਣੀਆਂ ਗਾਣੇ ਲਗਾਉਣੇ ਬਹੁਤ ਹੀ ਧੂਮ ਧੜੱਕੇ ਨਾਲ ਗੀਤ ਗਾਏ ਜਾਂਦੇ ਹਨ ਪੰਜਾਬੀ ਬੋਲੀਆਂ ਜੋ ਕਿ ਬੋ ਬਜ਼ੁਰਗ ਔਰਤਾਂ ਵੀ ਇਕੱਠੀਆਂ ਹੋ ਕੇ ਪੰਜਾਬੀ ਵਿੱਚ ਹੀ ਬੋਲੀਆਂ ਪਾਉਂਦੀਆਂ ਹਨ ਪੰਜਾਬੀ ਗੀਤ ਨਾਲ ਵਜਾਏ ਜਾਂਦੇ ਹਨ ਪੰਜਾਬ ਵਿੱਚ ਹਰ ਤਰ੍ਹਾਂ ਦੀ ਭਾਸ਼ਾ ਬੋਲੀ ਜਾਂਦੀ ਹੈ ਪਰ ਸਭ ਤੋਂ ਵੱਧ ਮਹੱਤਤਾ ਪੰਜਾਬੀ ਨੂੰ ਦਿੱਤੀ ਜਾਂਦੀ ਹੈ ਇਹ ਇਹੋ ਜਿਹੀ ਭਾਸ਼ਾ ਹੈ ਜੋ ਕਿ ਬਹੁਤ ਹੀ ਪਿਆਰੀ ਲੱਗਦੀ ਹੈ ਇਸ ਬੋਲੀ ਨਾਲ ਹੀ ਸਾਡੀ ਪਛਾਣ ਹੈ ਇਸ ਬੋਲੀ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬਹੁਤ ਮਹੱਤਤਾ ਮਿਲੀ ਹੈ ਆਪਾਂ ਚਲੇ ਜਾਈਏ ਕਨੇਡਾ ਵਗ ਜਾਈਏ ਸਰੀ ਪੰਜਾਬ ਲੱਗਦਾ ਹੈ ਉੱਥੇ ਵੀ ਬਹੁਤ ਜ਼ਿਆਦਾ ਲੋਕ ਪੰਜਾਬੀ ਬੋਲਦੇ ਹਨ ਪੰਜਾਬੀ ਇੱਕ ਅਜਿਹੀ ਪਿਆਰੀ ਭਾਸ਼ਾ ਹੈ ਜੋ ਕਿ ਹਰ ਇੱਕ ਨੂੰ ਮੋਹ ਲੈਂਦੀ ਹੈ ਪੰਜਾਬੀ ਬੋਲਣ ਵਾਲਾ ਹਰ ਇੱਕ ਆਦਮੀ ਤੁਹਾਨੂੰ ਪੰਜਾਬੀ ਵਿੱਚ ਬਹੁਤ ਹੀ ਇੱਜਤ ਮਾਣ ਬਖਸ਼ਦਾ ਹੈ ਲੋਕ ਇਸ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਹਨ ਪੰਜਾਬੀ ਸਾਡੀ ਮਾਣ ਅਤੇ ਸਨਮਾਨ ਨੂੰ ਵਧਾਉਂਦੀ ਹੈ ਪੰਜਾਬੀ ਭਾਸ਼ਾ ਨੇ ਸਾਡੇ ਬਹੁਤ ਹੀ ਗੀਤ ਬਹੁਤ ਮਸ਼ਹੂਰ ਹੋਏ ਨੇ ਜੋ ਕਿ ਸਿੱਧੂ ਮੂਸੇਆਲਾ ਸਾਡਾ ਮਾਨਸਾ ਦਾ ਬਹੁਤ ਹੀ ਪਿਆਰਾ ਕਲਾਕਾਰ ਸੀ ਜਿਸ ਨੇ ਬਿੱਲਬੋਰਡ ਤੱਕ ਵੀ ਸਾਡੀ ਪੰਜਾਬੀ ਭਾਸ਼ਾ ਨੂੰ ਪਹੁੰਚਾ ਦਿੱਤਾ ਸੀ ਗੋਰੇ ਕੀ ਕਾਲੇ ਕੀ ਸਾਡੇ ਅੱਜ ਹਰੇਕ ਪੰਜਾਬੀ ਗਾਣਾ ਸੁਣਨ ਨੂੰ ਪਹਿਲ ਦਿੰਦੇ ਹਨ ਧੰਨਵਾਦ